ਸਤਿ ਸ਼੍ਰੀ ਅਕਾਲ ਜੀ ਮੈਂ ਅਰਮਾਨ ਸਿੰਘ ਮੈਂ ਪਿਛਲੇ ਹਫਤੇ ਤੁਹਾਡੇ ਔਨਲਾਈਨ ਤੁਹਾਡੇ ਹੈੱਡਫੋਨ ਰਿਸੀਵ ਕੀਤੇ ਸੀ ਜੋ ਕਿ ਉਹ ਮੇਰੇ ਪਹੁੰਚ ਚੁੱਕੇ ਹਨ ਮੈਂ ਅਸੀ ਉਹ ਦੇਖੇ ਉਹ ਤੁਹਾਡੇ ਹੈੱਡਫੋਨ ਦੀ ਪੈਕਿੰਗ ਬਹੁਤ ਹੀ ਵਧੀਆ ਹਨ ਜਦੋਂ ਤੁਹਾਡੇ ਜੋ ਵੀ ਤੁਸੀਂ ਕਿਹਾ ਸੀ ਉਹਨਾਂ ਦੀ ਕੁਆਲਿਟੀ ਉਹਨਾਂ ਤੋਂ ਵੀ ਬੈਟਰ ਹਨ ਉਹਨਾਂ ਦੀ ਸਾਊਂਡ ਜਿਹੜੀ ਹੈ ਉਹ ਬਹੁਤ ਹੀ ਵਧੀਆ ਹੈ ਅਤੇ ਉਸਦੇ ਵਿੱਚ ਲੌਟ ਆਫ ਨਵੇਂ ਨਵੇਂ ਹੀ ਤਰੀਕੇ ਦੀਆਂ ਫੀਚਰ ਹਨ ਜੋ ਕਿ ਮੈਨੂੰ ਬਹੁਤ ਹੀ ਪਸੰਦ ਲੱਗੇ ਅਤੇ ਹਨ ਇਸ ਤੋਂ ਬਾਅਦ ਮੇਰੇ ਫਰੈਂਡ ਨੇ ਵੀ ਮੇਰੇ ਤੋਂ ਪੁੱਛਿਆ ਨੇ ਤੁਸੀਂ ਆਹ ਆਹ ਹੈੱਡਫੋਨ ਕਿੱਥੋਂ ਖਰੀਦੇ ਹਨ ਅਤੇ ਮੈਂ ਉਹਨਾਂ ਨੂੰ ਦੱਸਿਆ ਹੈ ਕਿ ਆਹ ਮੈਂ ਹੈੱਡਫੋਨ ਔਨਲਾਈਨ ਖਰੀਦੇ ਹਨ ਅਤੇ ਮੈਂ ਦੱਸਿਆ ਹੈ ਕਿ ਇਹ ਹੈੱਡਫੋਨ ਮੈਂ ਸਿਰਫ਼ ਹਜ਼ਾਰ ਰੁਪਏ ਵਿੱਚ ਹੀ ਖਰੀਦੇ ਹਨ ਅਤੇ ਇਸ ਹੈੱਡਫੋਨ ਦੀ ਉਹਨਾਂ ਨੇ ਵੀ ਥ ਬਹੁਤ ਬਹੁਤ ਤਾਰੀਫ ਕੀਤੀ ਹੈ